ਭੰਗੜਾ ਐਰੋਬਿਕਸ ਦੀ ਕੋਰਿਓਗ੍ਰਾਫੀ ਮੈਂ ਬਹੁਤ ਚੰਗੀ ਤਰ੍ਹਾਂ ਬਣਾਉਂਦੀ ਹਾਂ ਸਭ ਤੋਂ ਪਹਿਲਾਂ ਮੈਂ ਗਾਣਾ ਜੋਸ਼ੀਲਾ ਚਾਹੁੰਦੀ ਹਾਂ ਜੋ ਅੱਜ ਕੱਲ੍ਹ ਚੱਲ ਰਿਹਾ ਹੋਵੇ ਜੋ ਲੋਕਾਂ ਨੂੰ ਪਸੰਦ ਹੋਵੇ ਅਤੇ ਮੈਂ ਗਾਣੇ ਦੇ ਸਟੈਪ ਬੋਲਾਂ ਨਾਲ ਮੈਚ ਕਰਦੀ ਹਾਂ ਅਤੇ ਮੈਂ ਸੈਪ ਸਟੈਪ ਬੜੇ ਸੌਖੇ ਤਰੀਕੇ ਨਾਲ ਹੋਣ ਦੇ ਨਾਲ ਨਾਲ ਸਰੀਰ ਨੂੰ ਵੀ ਚੰਗੇ ਤਰ੍ਹਾਂ ਵੀ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਪਸੀਨਾ ਆਵੇ ਅਤੇ ਚੰਗੀ ਤਰ੍ਹਾਂ ਕਸਰਤ ਹੋਵੇ ਇਸ ਦੇ ਨਾਲ ਕਈ ਵਾਰ ਮੈਂ ਸੋਸਲ ਮੀਡੀਆ ਤੋਂ ਕਿਸੇ ਦਾ ਸਟੈਪ ਚੰਗੇ ਲੱਗੇ ਤਾਂ ਮੈਂ ਆਪਣੇ ਕੋਰੋਗ੍ਰਾਫੀ 'ਚੋਂ ਜੋੜ ਲੈਂਦੀ ਹਾਂ ਇਸ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਭੰਗੜਾ ਐਰੋਬਿਕਸ ਦੀ ਕੋਰਿਓਗਰਾਫੀ ਬਣਾਈ ਜਾਂਦੀ ਹੈ ਅਤੇ ਇਹ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ ਅਤੇ ਮੇਰੇ ਸਰੀਰ 'ਚ ਵਧੀਆ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਜ਼ਿਆਦਾਤਰ ਸਟੈਪ ਵਧੀਆ ਹੈ ਹੋਣੇ ਚਾਹੀਦੇ ਹਨ ਅਤੇ ਗਾਣਾ ਵੀ ਚੰਗਾ ਹੋਣਾ ਚਾਹੀਦਾ ਹੈ ਅਤੇ ਭੰਗੜਾ ਚੰਗੀ ਤਰ੍ਹਾਂ ਸਟੇਪ ਨਾਲ ਕਰਨਾ ਚਾਹੀਦਾ ਹੈ ਅਤੇ ਵਧੀਆ ਤਰੀਕੇ ਨਾਲ ਆਉਣਾ ਚਾਹੀਦਾ ਹੈ ਅਤੇ ਗਾਣਾ ਵੀ ਚੰਗਾ ਹੋਣਾ ਚਾਹੀਦਾ